ਪੁਰਾਣੇ ਜ਼ਮਾਨੇ ਦੇ ਫੋਟੋਗ੍ਰਾਫਰ ਅਤੇ ਫੋਟੋਗ੍ਰਾਫੀ ਨਾਲ ਅੱਜ ਦੇ ਜ਼ਮਾਨੇ ਦੀ ਫੋਟੋਗ੍ਰਾਫੀ ਵਿੱਚ ਬਹੁਤ ਫਰਕ ਹੈ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਕੈਮਰਾ ਨੇ ਉਹ ਇੰਨੇ ਕੁ ਇੰਨਾਂ ਕੁ ਤਰੱਕੀ ਨਹੀਂ ਹੋਈ ਸੀ ਕਿ ਉਦ ਉਹਨਾਂ ਵਜੋਂ ਅਸੀਂ ਜਿਹੜੀ ਹੈ ਉਹ ਕਲਰਡ ਫੋਟੋਗ੍ਰਾਫੀ ਕਰ ਸਕੀਏ ਅਤੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਫੋਟੋਗ੍ਰਾਫਰ ਸੀਗੇ ਉਹ ਰੀਲ ਪਾ ਕੇ ਕੈਮਰੇ ਵਿੱਚ ਬਲੈਕ ਐਂਡ ਵਾਈਟ ਫੋਟੋ ਨੂੰ ਖਿੱਚਦੇ ਸਨ ਇਸ ਤੋਂ ਬਾਅਦ ਕਲਰਡ ਫੋਟੋਗ੍ਰਾਫਰ ਫੋਟੋਗ੍ਰਾਫੀ ਆ ਗਈ ਅਤੇ ਟਾਈਮ ਨਾਲ ਜਦੋਂ ਸਮਾਂ ਚੇਂਜ ਹੋਇਆ ਸਾ ਸਮੇਂ ਬਦਲਣ ਨਾਲ ਜਿਹੜੇ ਅੱਜ ਦੇ ਫੋਟੋਗ੍ਰਾਫਰ ਨੇ ਉਹਨਾਂ ਨੂੰ ਕੋਈ ਬਾਰ ਬਾਰ ਰੀਲ ਨਹੀਂ ਪਾਉਣੀ ਪੈਂਦੀ ਉਹ ਜਿਹੜੇ ਇਲੈਕਟਰੋਨਿਕ ਯਾ ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਕੈਮਰਾ ਦਾ ਪ੍ਰਯੋਗ ਕਰਦੇ ਹਨ ਅਤੇ ਉਹਨਾਂ ਕੈਮਰਾ ਨੂੰ ਯੂਜ ਕਰਕੇ ਉਹ ਵਧੀਆ ਤਰੀਕੇ ਨਾਲ ਫੋਟੋਗ੍ਰਾਫੀ ਕਰਦੇ ਹਨ ਅਤੇ ਇੰਨੀ ਕੁ ਤਰੱਕੀ ਹੋ ਗਈ ਕੈਮਰਿਆਂ ਦੀ ਵਧੀਆ ਕੈਮਰਿਆਂ ਦੇ ਆਉਣ ਨਾਲ ਕਿ ਹੁਣ ਜਿਹੜੇ ਫੋਟੋਗ੍ਰਾਫਰ ਨੇ ਉਹ ਚੰਗੇ ਤਰੀਕੇ ਨਾਲ ਫੋਟੋਗ੍ਰਾਫੀ ਦਾ ਕੋਰਸ ਕਰਦੇ ਹਨ ਅਤੇ ਇਹਦੀ ਚੰਗੀ ਤਰ੍ਹਾਂ ਮਹਾਰਤ ਹਾਸਿਲ ਕਰਦੇ ਹਨ ਫੋਟੋਗ੍ਰਾਫੀ ਦੀ ਵਿੱਦਿਆ ਵੀ ਅੱਜ ਕੱਲ੍ਹ ਇੱਕ ਵਿੱਦਿਆ ਮੰਨੀ ਜਾਂਦੀ ਹੈ ਉਹਨਾਂ ਵਿੱਚ ਕਈ ਤਰੀਕਿਆਂ ਦੀਆਂ ਟਕਨੀਕਸ ਸਿਖਾਈਆਂ ਜਾਂਦੀਆਂ ਹਨ ਫੋਟੋਗ੍ਰਾਫਰ ਨੂੰ ਕਿ ਕਿਵੇਂ ਕਿਸ ਤਰੀਕੇ ਨਾਲ ਉਹ ਬੰਦਿਆਂ ਦੀਆਂ ਜਾਨਵਰਾਂ ਦੀਆਂ ਫੁੱਲਾਂ ਦੀਆਂ ਪਕਸ਼ੀਆਂ ਦੀਆਂ ਹਰ ਚੀਜ਼ ਦੀਆਂ ਚੰਗੀ ਤਕਨੀਕ ਨਾਲ ਉਹ ਫੋਟੋਗ੍ਰਾਫ ਖਿੱਚ ਸਕਦਾ ਹੈ ਅਤੇ ਇਸ ਤਰੱਕੀ ਨਾਲ ਇਹ ਫਾਇਦਾ ਸਾਨੂੰ ਹੋ ਗਿਆ ਕਿ ਅਸੀਂ ਹਰ ਇੱਕ ਸਮੇਂ ਦੀ ਇੱਕ ਇੱਕ ਪਲ ਦੀ ਮੂਮੈਂਟ ਨੂੰ ਚੰਗੀ ਤਰ੍ਹਾਂ ਕੈਮਰਾ ਰਾਹੀਂ ਕਵਰ ਕਰ ਸਕਦੇ ਹਨ